ਸਾਡੇ ਪੰਜਾਬ ਦੇ ਖੇਤਰ ਵਿੱਚ ਕਈ ਸਾਰੀ ਰਵਾਇਤੀ ਖੇਡਾਂ ਹਨ ਜਿਵੇਂ ਗੱਤਕਾ ਕਬੱਡੀ ਬਾਸਕਿਟਬਾਲ ਫੁੱਟਬਾਲ ਆਦਿ ਅਸੀਂ ਇਹਨਾਂ ਗੇਮਾਂ ਨੂੰ ਆਮ ਤੌਰ ਤੇ ਟੀਮਾਂ ਬਣਾ ਕੇ ਖੇਡਦੇ ਹਾਂ ਜਿਵੇਂ ਕਬੱਡੀ ਵਿੱਚ ਆਮ ਤੌਰ 'ਤੇ ਸੱਤ ਬੰਦੇ ਖੇਡਦੇ ਹਨ ਇੱਕ ਸਾਈਡ ਅਤੇ ਦੂਜੀ ਸਾਈਡ ਵੀ ਸੱਤ ਬੰਦੇ ਹੁੰਦੇ ਹਨ ਇੱਕ ਬੰਦਾ ਜਾ ਕੇ ਉਹਨਾਂ ਨੂੰ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਹੱਥ ਲਗਾ ਕੇ ਆਪਣੇ ਪਾੜੇ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਦੂਜੇ ਪਾੜੇ ਵਾਲੇ ਉਹਨਾਂ ਨੂੰ ਉਸ ਉਸ ਇੱਕ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਇਸੇ ਤਰ੍ਹਾਂ ਫੁੱਟਬਾਲ ਵਿੱਚ ਇੱਕ ਬਾਲ ਹੁੰਦੀ ਹੈ ਜਿਸ ਨੂੰ ਸਾਰੇ ਲੱਤਾਂ ਨਾਲ ਖੇਡ ਮਾਰ ਮਾਰ ਕੇ ਗੋਲ ਇੱਕ ਇੱਕ ਗੋਲ ਵਿੱਚ ਪਾਉਂਦੇ ਹਨ ਜਿਵੇਂ ਕੀ ਹੋਰ ਵੀ ਕਈ ਖੇਡਾਂ ਹਨ ਗਤਕਾ ਗਤਕਾ ਪੰਜਾਬੀ ਸੱਭਿਆਚਾਰ ਦੀ ਕਾਫੀ ਪੁਰਾਣੀ ਖੇਡ ਹੈ ਜਿਸ ਵਿੱਚ ਜਿਸ ਵਿੱਚ ਕਾਫੀ ਸਾਰੀ ਚੀਜ਼ਾਂ ਹੁੰਦੀਆਂ ਹਨ ਜਿਵੇਂ ਤਲਵਾਰਬਾਜ਼ੀ ਤੀਰ ਕਮਾਨ ਆਦਿ ਚੀਜ਼ਾਂ ਹੁੰਦੀਆਂ ਹਨ ਇਹ ਸਾਰੀਆਂ ਖੇਡਾਂ ਪੰਜਾਬ ਦੀ ਰਵਾਇਤੀ ਖੇਡਾਂ ਹਨ ਕਈ ਬਹੁਤ ਸਾਰੇ ਲੋਕ ਇਹਨਾਂ ਖੇਡਾਂ ਨੂੰ ਖੇਡਦੇ ਹਨ